ਬਿਜਲੀ ਦੇ ਕੱਟ ਦੌਰਾਨ ਸਾਨੂੰ ਬਹੁਤ ਪ੍ਰਭਾਵ ਪੈਂਦਾ ਹੈ ਕਿਓਂ ਅਸੀਂ ਬਿਜਲੀ 'ਤੇ ਇੰਨੇ ਨਿਰਭਰ ਹਾਂ ਜੋ ਵੀ ਖਾਣਾ ਏ ਸੀ ਕੂਲਰ ਜਾਂ ਸਾਡਾ ਜਿਹੜਾ ਮਤਲਬ ਵੀ ਆਪਣਾ ਡੇਲੀ ਦਾ ਓਫਿਸ ਦੇ ਵਿੱਚ ਜਾਂ ਕਿਤੇ ਵੀ ਅਸੀਂ ਮਤਲਬ ਕੋਈ ਵਰਕ ਕਰਦੇ ਹਾਂ ਤਾਂ ਸਾਡੇ ਜਿੰਨੇ ਵੀ ਮਤਲਬ ਉਪਕਰਨ ਨੇ ਇਹ ਸਭ ਬਿਜਲੀ 'ਤੇ ਚੱਲਦੇ ਨੇ ਜਦੋਂ ਬਿਜਲੀ ਦਾ ਕੋਈ ਵੀ ਕੱਟ ਲੱਗਦਾ ਹੈ ਤਾਂ ਸਭ ਪ੍ਰਭਾਵਿਤ ਹੁੰਦਾ ਹੈ ਜਿਵੇਂ ਵੀ ਮਤਲਬ ਕੋਈ ਕੰਪਿਊਟਰ ਹੈ ਕੋਈ ਇੰਨਵਟਰ ਹੈ ਕੋਈ ਮਤਲਬ ਕਿਸੇ ਕਿਸਮ ਦਾ ਵੀ ਕੋਈ ਵੀ ਮਤਲਬ ਕੁਝ ਹੈ ਹੀਟਰ ਹੈ ਕੋਈ ਵੀ ਉਪਕਰਨ ਹੈ ਉਪਕਰਨ ਦੇ ਵਿੱਚ ਸਾਰੇ ਹੀ ਆ ਗਏ ਨਾ ਬੜਾ ਮਤਲਬ ਵੱਡਾ ਬਹੁਤ ਜ਼ਿਆਦਾ ਮਤਲਬ ਵੀ ਪ੍ਰਭਾਵ ਕਰਦੀ ਹੈ ਅਸੀਂ ਬਿਜਲੀ 'ਤੇ ਇੰਨੇ ਕੁ ਨਿਰਭਰ ਹੋ ਚੁੱਕੇ ਹੈ ਕਿ ਜੇਕਰ ਮਤਲਬ ਰਾਤ ਨੂੰ ਸਾਡੀ ਲਾਈਟ ਜਾਂ ਲਾਈਟ ਦਾ ਕੱਟ ਲੱਗ ਜਾਂਦਾ ਹੈ ਤਾਂ ਨ੍ਹੇਰੇ ਦੇ ਵਿੱਚ ਸਾਨੂੰ ਬੜੀ ਘਬਰਾਹਟ ਹੁੰਦੀ ਹੈ ਬੜਾ ਸਾਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਮਤਲਬ ਜਿਹੜਾ ਕੱਟ ਲੱਗਿਆ ਹੋਇਆ ਹੈ ਕੱਟ ਨਹੀਂ ਲੱਗਣਾ ਚਾਹੀਦਾ ਬਿਜਲੀ ਦੇ ਜੋ ਮਤਲਬ ਕੱਟ ਲੱਗਣ ਦੇ ਵੀ ਦੋ ਤਿੰਨ ਕਾਰਨ ਹੈ ਇੱਕ ਜਿਹੜੀ ਬਿਜਲੀ ਹੈ ਉਹ ਸਾਡੇ ਕਿਸਾਨਾਂ ਨੂੰ ਫ੍ਰੀ ਦਿੱਤੀ ਜਾ ਰਹੀ ਹੈ ਸਾਨੂੰ ਵੀ ਮਤਲਬ ਪੰਜਾਬ ਦੇ ਵਿੱਚ ਸਾਨੂੰ ਵੀ ਇੰਨੇ ਯੂਨਿਟ ਫ੍ਰੀ ਨੇ ਉਹ ਫ੍ਰੀ ਕੀਤੇ ਹੋਏ ਨੇ ਇਸ ਕਰਕੇ ਉਹ ਸਾਡੇ ਫਾਇਦੇ ਲਈ ਕਰ ਰਹੇ ਨੇ ਪਰ ਉਹਦੇ ਲਈ ਮਤਲਬ ਸਾਨੂੰ ਉਹ ਅੱਛਾਈ ਵੀ ਹੋ ਰਹੀ ਹੈ ਦੂਜੇ ਪਾਸੇ ਮਤਲਬ ਜਿਹੜੀ ਇੰਨੀ ਬਿਜਲੀ ਹੈ ਉਹਦੀ ਕੰਜਪਸ਼ਨ ਇੰਨੀ ਹੈ ਉਹਦੇ ਲਈ ਫਿਰ ਮਤਲਬ ਜਿਹੜੀ ਬਿਜਲੀ ਹੈ ਬਿਜਲੀ ਦੇ ਕੱਟ ਲੱਗਣੇ ਸੰਭਵ ਨੇ ਪਰ ਅਸੀਂ ਇੰਨੇ ਬਿਜਲੀ 'ਤੇ ਡਿਪੈਂਡ ਹੋ ਚੁੱਕੇ ਹੈ ਇੰਨੇ ਕੁ ਡਿਪੈਂਡ ਹੋ ਚੁੱਕੇ ਹੈ ਕਿ ਅਸੀਂ ਮਤਲਬ ਜਿਹੜਾ ਬਿਜਲੀ ਦਾ ਕੋਈ ਵੀ ਮਤਲਬ ਕੱਟ ਲੱਗਦਾ ਹੈ ਤਾਂ ਸਾਨੂੰ ਬੜਾ ਫੀਲ ਹੁੰਦਾ ਹੈ ਇਸ ਦੌਰਾਨ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕੋਈ ਇੰਵਲਟਰ ਕੋਈ ਜਰਨੇਟਰ ਕੋਈ ਬਿਜਲੀ ਦਾ ਇੱਦਾਂ ਦਾ ਸੋਰਸ ਨਹੀਂ ਸੀ ਲੋਕ ਛੱਤਾਂ ਦੇ ਉੱਪਰ ਜਾਂ ਮਤਲਬ ਵੀ ਆਪਣਾ ਖੁੱਲ੍ਹੇ ਲੋਕਾਂ ਦੇ ਘਰ ਹੁੰਦੇ ਸੀਗੇ ਆਬਾਦੀ ਬਹੁਤ ਘੱਟ ਸੀਗੀ ਓਦੋਂ ਲੋਕ ਮਤਲਬ ਬਿਜਲੀ ਦੀ ਕੋਈ ਖਾਸ ਮਤਲਬ ਉਹ ਨਹੀਂ ਸੀ ਲਾਲਟੇਨ ਵਗੈਰਾ ਜਾਂ ਮਤਲਬ ਚਲੋ ਅਗਲਾ ਕੋਈ ਮੋਮਬੱਤੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਪਰ ਉਹ ਕੋਈ ਉਪਕਰਨ ਇੱਦਾਂ ਦਾ ਮਤਲਬ ਕੋਈ ਉਹ ਨਹੀਂ ਸੀ ਹੁਣ ਉਪਕਰਨ ਜ਼ਿਆਦਾ ਹੋ ਗਏ ਹੁਣ ਸਾਰੇ ਹੀ ਅਸੀਂ ਬਿਜਲੀ 'ਤੇ ਡਿਪੈਂਡ ਹਾਂ ਇਸ ਕਰਕੇ ਹੁਣ ਜਿਹੜਾ ਅੱਜ ਦਾ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਹੁਣ ਸਾਨੂੰ ਖੈਰ ਮਤਲਬ ਕੋਈ ਕੱਟ ਦਾ ਕੋਈ ਖਾਸ ਜਿਹੜਾ ਮਤਲਬ ਜਿਨ੍ਹਾਂ ਕੋਲ ਇੰਨਵਟਰ ਹੈ ਜਿਨ੍ਹਾਂ ਕੋਲ ਜਰਨੇਟਰ ਹੈ ਜਿਨ੍ਹਾਂ ਕੋਲ ਮਤਲਬ ਬਿਜਲੀ ਦਾ ਕੋਈ ਹੈਗੇ ਨੇ ਮਤਲਬ ਕੋਈ ਵੀ ਸਾਧਨ ਹੈ ਉਹ ਉਨ੍ਹਾਂ ਨੂੰ ਕੱਟ ਦਾ ਕੋਈ ਖਾਸ ਮਹਿਸੂਸ ਨਹੀਂ ਹੁੰਦਾ ਜਿਹੜਾ ਅਮੀਰ ਹੈ ਜਾਂ ਜਿਹੜੇ ਮਤਲਬ ਮਿਡਲ ਜਿਹੇ ਨੇ ਉਨ੍ਹਾਂ ਨੂੰ ਵੀ ਜਿਹੜੇ ਵਿਚਾਰੇ ਗਰੀਬ ਨੇ ਜਿਨ੍ਹਾਂ ਨੇ ਰੋਜ਼ੀ ਰੋਟੀ ਕਰਕੇ ਖਾਣੀ ਹੈ ਉਨ੍ਹਾਂ ਉਹ ਬੜੇ ਪ੍ਰਭਾਵਿਤ ਹੁੰਦੇ ਨੇ ਕਿਓਂ ਉਨ੍ਹਾਂ ਨੇ ਵਿਚਾਰਿਆਂ ਨੇ ਮਤਲਬ ਹੀਟਰ ਦੇ ਉੱਪਰ ਆਪਣਾ ਖਾਣਾ ਬਣਾਉਣਾ ਜਾਂ ਮਤਲਬ ਉਨ੍ਹਾਂ ਨੇ ਕੋਈ ਵੀ ਆਪਦਾ ਵਿਚਾਰਿਆਂ ਨੇ ਮਤਲਬ ਕੋਈ ਕੰਮ ਕਾਰ ਕਰਨਾ ਉਹ ਮਤਲਬ ਓਸੇ 'ਤੇ ਹੀ ਡਿਪੈਂਡ ਹੁੰਦੇ ਨੇ ਇਸ ਕਰਕੇ ਜਿਹੜੇ ਬਿਜਲੀ ਦੇ ਕੱਟ ਲੱਗੇ ਰਹੇ ਉਹ ਮੀਡੀਅਮ ਨੂੰ ਜੇ ਮਤਲਬ ਆਮ ਹਾਈ ਫਾਈ ਨੂੰ ਉਹਦਾ ਕੋਈ ਖਾਸ ਪ੍ਰਭਾਵ ਨਹੀਂ ਹੁੰਦੇ ਪ੍ਰਭਾਵਿਤ ਹੁੰਦਾ ਹੈ ਇੱਕ ਗਰੀਬ ਜਿਹੜਾ ਵਿਚਾਰਾ ਮਤਲਬ ਵੀ ਉਹਦੇ 'ਤੇ ਡਿਪੈਂਡ ਹੈ ਜਿਹਦੇ ਕੋਲ ਕੋਈ ਹੋਰ ਸੋਰਸ ਨਹੀਂ ਹੈਗਾ ਜਿਹਦੇ ਕੋਲ ਬਿਜਲੀ ਦਾ ਮਤਲਬ ਵਿਚਾਰੇ ਕੋਲ ਕੋਈ ਸੋਰਸ ਨਹੀਂ ਨਾ ਉਹਦੇ ਜਰਨੇਟਰ ਹੈ ਨਾ ਉਹਦੇ ਕੋਲ ਇੰਨਵਟਰ ਹੈ ਨਾ ਉਹਦੇ ਕੋਲ ਕੋਈ ਮਤਲਬ ਇੱਦਾਂ ਦਾ ਕੋਈ ਹੋਰ ਨਾ ਉਹਦੇ ਕੋਲ ਸੋਲਰ ਸਿਸਟਮ ਹੈ ਅੱਜ ਕੱਲ੍ਹ ਤਾਂ ਇੰਨੀ ਤਰੱਕੀ ਹੋ ਗਈ ਇੰਨਾਂ ਹੋ ਗਿਆ ਅੱਜ ਕੱਲ੍ਹ ਸੋਲਰ ਸਿਸਟਮ ਘਰ ਘਰ ਸੋਲਰ ਸਿਸਟਮ ਹੈ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਲਾਈਟ ਗਈ ਕਦੋਂ ਆ ਗਈ ਕਦੋਂ ਕੱਟ ਲੱਗੇ ਲੱਗਿਆ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਕਈ ਲੋਕਾਂ ਨੂੰ ਅਮੀਰ ਲੋਕਾਂ ਨੂੰ ਤਾਂ ਜਿਹਨਾਂ ਇਹ ਪ੍ਰਭਾਵ ਕੌਣ ਹੁੰਦਾ ਹੈ ਪ੍ਰਭਾਵ ਹੁੰਦਾ ਹੈ ਜਿਹੜਾ ਵਿਚਾਰਾ ਮਤਲਬ ਬਿਲਕੁਲ ਲੋਅ ਲੈਵਲ ਦਾ ਬੰਦਾ ਹੈ ਨੀਚੇ ਵਾਲਾ ਜਿਹਨੂੰ ਆਪਾਂ ਕਹਿ ਦਈਏ ਜਿਹੜੇ ਵਿਚਾਰੇ ਝੁੰਗੀਆਂ ਝੋਪੜੀਆਂ 'ਚ ਬੈਠੇ ਨੇ ਜਾਂ ਵਿਚਾਰੇ ਗਰੀਬ ਨੇ ਇੱਕ ਇੱਕ ਕਮਰੇ 'ਚ ਵਿਚਾਰੇ ਮਤਲਬ ਗਰੀਬੀ ਰੇਖਾ 'ਚ ਰਹਿ ਰਹੇ ਨੇ ਜਿਹੜੇ ਮਤਲਬ ਕੋਈ ਥੋੜ੍ਹੇ ਜਿਹੇ ਅਮੀਰ ਉੱਦਾਂ ਮਿਡਲ ਹੈਗੇ ਨੇ ਉਨ੍ਹਾਂ ਕੋਲ ਤਾਂ ਆਪੋ ਆਪਣੇ ਮਤਲਬ ਜਰਨੇਟਰ ਵਗੈਰਾ ਦਾ ਹੈਗਾ ਹੈ ਦੂਸਰਾ ਤੁਹਾਡਾ ਆਪਣਾ ਜਿਹੜੇ ਇੰਨਵਰਟਰ ਹੋ ਗਏ ਜਰਨੇਟਰ ਹੋ ਗਏ ਹੋਰ ਮਤਲਬ ਇਸ ਕਰਕੇ ਵੀ ਇਹ ਜਿਹੜਾ ਮਤਲਬ ਵੀ ਕੋਈ ਪ੍ਰਭਾਵ ਤਾਂ ਉਹੀ ਬੰਦੇ ਹੁੰਦੇ ਨੇ ਨਾ ਇਸ ਕਰਕੇ ਲਾਸਟ 'ਤੇ ਮੈਂ ਇਹੀ ਕਹੂੰਗਾ ਵੀ ਬਿਜਲੀ ਮਤਲਬ ਜਿਹੜੇ ਕੱਟ ਹੈ ਵੈਸੇ ਗਰੀਬ ਲਈ ਬਹੁਤ ਔਖਾ ਲੱਗ ਨਹੀਂ ਲੱਗਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਜੀ